ਮੈਨੂੰ ਆਰਟ ਗਰਾ ਆਰਟ ਐਂਡ ਕ੍ਰਾਫਟ ਅਤੇ ਕਢਾਈ ਬੁਣਾਈ ਦਾ ਬਹੁਤ ਈ ਜਿਆਦਾ ਸ਼ੌਂਕ ਐ ਮੈਂ ਆਪਣੇ ਵਿਹਲੇ ਸਮੇਂ ਦਾ ਉਪਯੋਗ ਇਸ ਤਰ੍ਹਾਂ ਕਰਦੀ ਹਾਂ ਕਿ ਅਲੱਗ ਅਲੱਗ ਚੀਜਾਂ ਨੂੰ ਸਿੱਖਣਾ ਬਣਾਉਣਾ ਮੈਨੂੰ ਬਹੁਤ ਹੀ ਪਸੰਦ ਐ ਜਿਆਦਾਤਰ ਮੈਂ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੀ ਮਨਪਸੰਦ ਚੀਜਾਂ ਬਣਾਉਂਦੀ ਹਾਂ ਅਤੇ ਆਪਣੀ ਮੰਮੀ ਅਤੇ ਦਾਦੀ ਨਾਨੀ ਭੂਆ ਜੀ ਸਭ ਕੁਛ ਸਿੱਖਦੀ ਹਾਂ ਮੈਨੂੰ ਇਹ ਸਭ ਕੁਛ ਬਹੁਤ ਪਸੰਦ ਹੈ ਵਾਧੂ ਚੀਜ਼ਾਂ ਵੇਸਟ ਮਟੀਰੀਅਲ ਦਾ ਇਸਤੇਮਾਲ ਕਰਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ ਮੈਂ ਆਪਣੇ ਘਰ ਨੂੰ ਡੈਕੋਰੇਟ ਵੀ ਇਸ ਤਰ੍ਹਾਂ ਹੀ ਕਰਦੀ ਹਾਂ ਬਜ਼ਾਰ ਦੀਆਂ ਚੀਜ਼ਾਂ ਬ ਬਹੁਤ ਹੀ ਮਹਿੰਗੀਆਂ ਹੁੰਦੀਆਂ ਹਨ ਪਰ ਬਜ਼ਾਰ ਦੀਆਂ ਚੀਜ਼ਾਂ ਬਹੁਤ ਈ ਮਹਿੰਗੀਆਂ ਹੁੰਦੀਆਂ ਹਨ ਪਰ ਮੈਂ ਇੱਕ ਬਹੁਤ ਬਜ਼ਾਰ ਦਾ ਸਮਾਨ ਬਹੁਤ ਈ ਘੱਟ ਖਰੀਦਦੀ ਹਾਂ ਮੈਂ ਜ਼ਿਆਦਾਤਰ ਆਪਣੇ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਨਾਲ ਹੀ ਆਪਣਾ ਘਰ ਡੈਕੋਰੇਟ ਕਰਦੀ ਹਾਂ ਮੈਂ ਕਲੇਅ ਮੈਨੂੰ ਕਲੇਅ ਆਰਟ ਕਰਨਾ ਬਹੁਤ ਪਸੰਦ ਐ ਕਲੇਅ ਤੋਂ ਮੈਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਿਵੇਂ ਕੀ ਬਰੈਸਲੇਟ ਜਿਵੇਂ ਕੀ ਬਰੈਸਲੇਟ ਕੰਗਣ ਜਾਂ ਫਿਰ ਏਰਿੰਗ ਕਹਿ ਸਕਦੇ ਹਾਂ ਜੋ ਕੀ ਮੇਰੇ ਘਰਦਿਆਂ ਨੂੰ ਬਹੁਤ ਈ ਪਸੰਦ ਆਈਆਂ ਮੇ ਇੱਕ ਦਿਨ ਮੇਰੀ ਸਹੇਲੀ ਮੇਰੇ ਘਰ ਆਈ ਜਿਸ ਨੇ ਕੀ ਮੇਰੀਆਂ ਕਲੇਅ ਆਰਟ ਬਣਿਆ ਹੋਇਆ ਬਰੈਸਲੇਟ ਦੇਖਿਆ ਉਸਨੂੰ ਉਹ ਬਹੁਤ ਪਸੰਦ ਆਇਆ ਉਸ ਤੋਂ ਥੋੜੇ ਦਿਨ ਹੀ ਬਾਦ ਹੀ ਉਸਦਾ ਜਨਮਦਿਨ ਸੀ ਤੇ ਮੈਂ ਉਸਨੂੰ ਉਸੇ ਤਰ੍ਹਾਂ ਦਾ ਹੀ ਇੱਕ ਬਰੈਸਲੇਟ ਬਣਾ ਕੇ ਦਿੱਤਾ ਜਿਸ ਵਿੱਚ ਮੇਰੀ ਬਹੁਤ ਮਿਹਨਤ ਲੱਗੀ ਮੈਂ ਉਹ ਬਰੈਸਲੇਟ ਬਹੁਤ ਹੀ ਪਿਆਰ ਨਾਲ ਬਣਾਇਆ ਸਾਰਾ ਸਭ ਕੁਛ ਸੋਚ ਕੇ ਕੀ ਮੇਰੀ ਸਹੇਲੀ ਨੂੰ ਕਿਸ ਤਰ੍ਹਾਂ ਕੇ ਕਿਹੜੇ ਕਿਹੜੇ ਰੰਗ ਪਸੰਦ ਹਨ ਉਸਨੂੰ ਉਹ ਕਿਸ ਤਰ੍ਹਾਂ ਦਾ ਬਰੈਸਲੇਟ ਪਸੰਦ ਆਵੇਗਾ ਇਹ ਸਾਰਾ ਕੁਛ ਸੋਚ ਕੇ ਮੈਂ ਉਹਦੇ ਲਈ ਬਹੁਤ ਹੀ ਪਿਆਰ ਨਾਲ ਬਰੈਸਲੇਟ ਬਣਾਇਆ ਤੇ ਮੈਂ ਉਸਦੇ ਜਨਮਦਿਨ ਤੇ ਉਸਨੂੰ ਉਹੀ ਗਿਫਟ ਕੀਤਾ ਜੋ ਕੀ ਉਸਨੂੰ ਬਹੁਤ ਈ ਪਸੰਦ ਆਇਆ ਉਸਦੇ ਨਾਲ ਨਾਲ ਮੇਰੀਆਂ ਬਾਕੀ ਸਹੇਲੀਆਂ ਅਤੇ ਉਸਦੇ ਮੰਮੀ ਡੈਡੀ ਨੂੰ ਵੀ ਉਹ ਬਹੁਤ ਈ ਪਸੰਦ ਆਇਆ ਉਸਨੇ ਮੇਰੀ ਬਹੁਤ ਈ ਤਾਰੀਫ ਕੀਤੀ ਜੋ ਕੀ ਮੈਨੂੰ ਬਹੁਤ ਵਧੀਆ ਲੱਗਿਆ ਇਨ੍ਹਾਂ ਸਭ ਦੇ ਨਾਲ ਨਾਲ ਮੈਂ ਕਢਾਈ ਬੁਣਾਈ ਵੀ ਸਿੱਖਦੀ ਹਾਂ ਜਿਸ ਦਾ ਮੈਨੂੰ ਬਹੁਤ ਹੀ ਸ਼ੌਂਕ ਹੈ ਮੈਂ ਆਪਣੀ ਮੰਮੀ ਤੋਂ ਬਹੁਤ ਸਾਰੇ ਸੁਐਟਰ ਬੁਣਨੇ ਸਿੱਖੇ ਐ ਅਲੱਗ ਅਲੱਗ ਤਰ੍ਹਾਂ ਦੀ ਡਿਜ਼ਾਇਨ ਔਨਲਾਈਨ ਦੇਖ ਕੇ ਮੈਂ ਆਪਣੇ ਆਪ ਬਣਾਏ ਜੋ ਕੀ ਬਹੁਤ ਈ ਵਧੀਆ ਬਣੇ ਸ਼ੁਰੂ ਸ਼ੁਰੂ ਵਿੱਚ ਇਹ ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਵਿੱਚ ਬਹੁਤ ਕਮੀਆਂ ਸਨ ਉਹ ਐਨੇ ਜਿਆਦਾ ਸੋਹਣੇ ਵੀ ਨਈਂ ਲੱਗਦੇ ਸਨ ਪਰ ਲਗਾਤਾਰ ਹੋਲੀ ਹੋਲੀ ਇਹ ਕੰਮ ਕਰਨ ਨਾਲ ਮੇਰੇ ਵਿੱਚ ਬਹੁਤ ਇੰਪਰੂਵਮੈਂਟ ਆਈ ਮੈਨੂੰ ਆਪਣੇ ਵਿਹਲੇ ਸਮੇਂ ਦਾ ਉਪਯੋਗ ਇਸ ਤਰ੍ਹਾਂ ਕਰਨਾ ਬਹੁਤ ਪਸੰਦ ਹੈ ਮੈਂ ਆਪਣੇ ਵਿਹਲੇ ਸਮੇਂ ਵਿੱਚ ਜਿਆਦਾਤਰ ਆਰਟ ਐਂਡ ਕ੍ਰਾਫਟ ਹੀ ਕਰਦੀ ਹਾਂ ਫੋਨ ਤੇ ਮੇਰਾ ਇਹ ਮੰਨਣਾ ਹੈ ਕਿ ਫੋਨ ਤੇ ਆਪਣਾ ਸਮਾਂ ਖਰਾਬ ਕਰਨ ਤੋਂ ਜਿਆਦਾ ਵਧੀਆ ਹੈ ਕਿ ਆਪਾਂ ਇਸ ਤਰ੍ਹਾਂ ਦਾ ਹੀ ਕੁਛ ਅਲੱਗ ਅਲੱਗ ਸਿੱਖੀਏ ਕੋਈ ਆਪਣੇ ਵਿੱਚ ਕਲਾ ਆਪਣੇ ਅੰਦਰੋਂ ਕੋਈ ਕਲਾ ਨੂੰ ਬਾਹਰ ਕੱਢੀਏ ਅਪ ਆਪਣੇ ਅੰਦਰੋਂ ਕੋਈ ਕਲਾ ਨੂੰ ਬਾਹਰ ਕੱਢੀਏ ਅਤੇ ਏਦਾਂ ਦਾ ਕੁਛ ਸਿੱਖੀਏ ਜੋ ਸਾਡੇ ਲਈ ਬਹੁਤ ਈ ਲਾਭਦਾਇਕ ਹੋਵੇ ਜੋ ਕੀ ਦੂਸਰਿਆਂ ਨੂੰ ਵੀ ਪਸੰਦ ਆਵੇ ਤੇ ਸਾਡੇ ਵਿਹਲੇ ਸਮੇਂ ਦਾ ਸਦਉਪਯੋਗ ਹੋਵੇ